ਜੀ ਸੰਸਾਰ ਜ਼ਰੂਰ ਬਦਲ ਗਿਆ ਹੈ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੋ ਗਈ ਹੈ ਵੀ ਆਪਣੇ ਵਿੱਚ ਬਹੁਤ ਐਡਵਾਂਸ ਸਮਝਦੇ ਲੋਕ ਆਪਣੇ ਆਪ ਨੂੰ ਟੈਕਨੋਲਜੀ ਕਾਫੀ ਤਰੱਕੀ 'ਚ ਜਾ ਰਹੀ ਆ ਜਿਵੇਂ ਕਿ ਆਪਾਂ ਇੱਕ ਫੋਨ ਦੀ ਉਦਾਹਰਨ ਹੀ ਲੈ ਲੈਂਦੇ ਹਾਂ ਅੱਜ ਕੱਲ੍ਹ ਫ ਫੋਨ 'ਤੇ ਆਪਾਂ ਮਿੰਟਾਂ ਸਕਿੰਟਾਂ 'ਚ ਕਿਤੇ ਦੂਰ ਦੇਸ਼ ਵਿਦੇਸ਼ ਕਿਸੇ ਸ਼ਹਿਰ ਵਿੱਚ ਗੱਲ ਕਰ ਸਕਦੇ ਹਾਂ ਰਿਸ਼ਤੇਦਾਰੀਆਂ ਵਿੱਚ ਵੀ ਫਰਕ ਪੈ ਰਿਹਾ ਇਹਦੇ ਕਰਕੇ ਰਿ ਦੁਨੀਆਂ ਬਦਲ ਰਹੀ ਆ ਵਾਕਿਆ ਬਦਲ ਰਹੀ ਆ ਕਿਉਂਕਿ ਪਹਿਲਾਂ ਫੋਨ ਨਹੀਂ ਸੀ ਆਪਸ 'ਚ ਰਿਸ਼ਤੇਦਾਰੀਆਂ ਦਾ ਬਹੁਤ ਪਿਆਰ ਸੀ ਇੱਕ ਦੂਜੇ ਨੂੰ ਮਿਲਣ ਦਾ ਚਾਅ ਸੀ ਦੇਖਣ ਦਾ ਚਾਅ ਸੀ ਕੋਈ ਆਵੇ ਪ੍ਰਾਹੁਣਾ ਅਤੇ ਖੁਸ਼ੀ ਮਹਿਸੂਸ ਕਰਦੇ ਸੀ ਪਰ ਹੁਣ ਅੱਜ ਕੱਲ੍ਹ ਕੀ ਹੋ ਗਿਆ ਫੋਨ ਦਾ ਜ਼ਮਾਨਾ ਏ ਆ ਫੋਨ 'ਤੇ ਗੱਲ ਕਰ ਲੈਂਦੇ ਆ ਫੋਨਾਂ ਕਰਕੇ ਰਿਸ਼ਤੇਦਾਰਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਪਹਿਲ ਹੁਣ ਵਟਸਐਪਾਂ ਇੰਨੀ ਗੱਲ ਆਪਸ 'ਚ ਨਹੀਂ ਕਰ ਸਕ ਕਰਦੇ ਹੈਗੇ ਜਿੰਨੀ ਆਪਾਂ ਪਹਿਲਾਂ ਮਿਲਵਰਤ ਕੇ ਖੁਸ਼ ਸੀ ਪਹਿਲਾਂ ਲੋਕ ਪ੍ਰੋਹਣਚਾਰੀ ਦਾ ਬਹੁਤ ਖੁਸ਼ ਹੋ ਹੋ ਕੇ ਵਰਤਦੇ ਸੀ ਵੀ ਹਾਂ ਸਾਡੇ ਆਇਆ ਪ੍ਰਾਹੁਣਾ ਅਸੀਂ ਖੁਸ਼ ਹੋ ਕੇ ਵਰਤਣਾ ਪਰ ਹੁਣ ਇਹ ਚੀਜ਼ਾਂ ਨਹੀਂ ਆ ਦੁਨੀਆਂ ਬਦਲ ਰਹੀ ਹੈ ਦਿਨੋ ਦਿਨ ਭੈਣ ਭਰਾ ਭੈਣ ਭਰਾ ਨਹੀਂ ਰਹਿ ਰਹੇ ਰਿਸ਼ਤਿਆਂ ਵਿੱਚ ਬਹੁਤ ਫਰਕ ਪੈ ਰਿਹਾ ਹੈ ਪਹਿਲਾਂ ਲੋਕ ਮਿਲਣਸਾਰ ਸੀ ਹੁਣ ਉਹ ਚੀਜ਼ਾਂ ਹੈ ਨਹੀਂ ਆ ਬਸ ਚੱਲੀ ਜਾਂਦਾ ਜਿਵੇਂ ਚਲੀ ਜਾਂਦਾ ਜਿਵੇਂ ਜਿਵੇਂ ਟੈਕਨੋਲਜੀ ਕਰੀ ਜਾਂਦੀ ਆ ਲੋਕਾਂ ਦਾ ਮੋਹ ਪਿਆਰ ਦੂਰ ਹੋ ਜਾਂਦਾ ਆਪਸ 'ਚ ਭੈਣ ਭਰਾ ਨਹੀਂ ਵਰਤਦੇ ਚਾਚੇ ਤਾਏ ਮਾਮੇ ਇਹਨਾਂ ਵਿੱਚ ਫਰਕ ਪੈ ਗਿਆ ਪਹਿਲੇ ਸਮਿਆਂ ਵਿੱਚ ਆਪਸ 'ਚ ਬਹੁਤ ਭੈਣਾਂ ਭਰਾਵਾਂ ਦਾ ਕੀ ਚਾਚੇ ਤਾਏ ਗਾਹਾਂ ਮਾਮੇ ਨਾਨੇ ਦੂਰ ਤੱਕ ਰਿਸ਼ਤੇਦਾਰੀਆਂ 'ਚ ਵਰਤਿਆ ਜਾਂਦਾ ਸੀ ਕਿਉਂਕਿ ਕਦੇ ਕਿਤੇ ਮੌਕਾ ਮਿਲਦਾ ਹੁੰਦਾ ਸੀ ਵਿਆਹ ਸ਼ਾਦੀਆਂ 'ਤੇ ਜਾਂ ਇਕੱਠੇ ਹੋਣਾ ਤਾਂ ਆਪਸ 'ਚ ਬਹੁਤ ਤਰੱਕੀ ਨਾਲ ਬਹੁਤ ਖੁਸ਼ੀ ਨਾਲ ਵਧੀਆ ਤਰੀਕੇ ਨਾਲ ਆਪਾਂ ਵਰਤਦੇ ਸੀ ਵੀ ਇਹ ਮੇਰਾ ਆਹ ਲੱਗਦਾ ਅੱਜ ਕੱਲ੍ਹ ਰਿਸ਼ਤਿਆਂ ਦੇ ਮਾਈਨੇ ਨਹੀਂ ਰਹੇ ਹੈਗੇ ਕੋਈ ਕਿਸੇ ਨੂੰ ਕੁਛ ਸਮਝਦਾ ਹੀ ਨਹੀਂ ਆ ਬਸ ਆਹੀ ਕੁਛ ਕਹਿਣਾ ਜੀ